ਘੁੰਮਣ ਵਾਸਤੇ ਸਾਰੀ ਦੁਨੀਆ ਵਧੀਆ ਜਿਹੜੇ ਮਰਜ਼ੀ ਦੇਸ਼ 'ਚ ਚਲੇ ਜਾਓ ਜਿਹੜੇ ਮਰਜ਼ੀ ਜਿਲ੍ਹੇ 'ਚ ਵਗ ਜਾਓ ਘੁੰਮਣ ਨੂੰ ਬਹੁਤ ਕੁਛ ਹੈ ਪਰ ਪਿੱਛੇ ਜਿਹੇ ਅਸੀਂ ਕੇਰਲਾ ਜਾ ਕੇ ਆਏ ਟਰੇਨ ਰਾਹੀਂ ਅਤੇ ਵਾਪਸੀ ਵੇਲੇ ਸਾਡਾ ਸਫ਼ਰ ਜਹਾਜ਼ ਰਾਹੀਂ ਸੀਗਾ ਅਤੇ ਐਨਾ ਆਨੰਦਮਈ ਸੀਗਾ ਕਿ ਮੈਂ ਕਿਹਾ ਦੱਸ ਨਹੀਂ ਸਕਦਾ ਕੁਛ ਇੱਥੋਂ ਅਸੀਂ ਟਰੇਨ 'ਤੇ ਗਏ ਸਾਨੂੰ ਦੋ ਦਿਨ ਲੱਗ ਗਏ ਰਸਤੇ ਵਿੱਚ ਕ ਕਈ ਆਇਆ ਆਪਣਾ ਬੰਬਈ ਆਈ ਹੋਰ ਆਈ ਦੇਖਣ ਨੂੰ ਵਾਤਾਵਰਨ ਬਦਲਿਆ ਫਿਰ ਅਸੀਂ ਕੇਰਲਾ ਪਹੁੰਚੇ ਕੇਰਲਾ ਦੇ ਵਿੱਚ ਸਮੁੰਦਰ ਉੱਥੇ ਅਸੀਂ ਬੋਟਿੰਗ ਕੀਤੀ ਉੱਥੇ ਆਪਣੇ ਆਪ ਨਾਰੀਅਲ ਬਹੁਤ ਹੁੰਦੇ ਆ ਅਤੇ ਘੁੰਮਣ ਲਈ ਬਹੁਤ ਜਗ੍ਹਾਵਾਂ ਸੀਗੀਆਂ ਮਾਹੌਲ ਸੀਗਾ ਹੋਰ ਨੇਚਰ ਪਾਰਕ ਵਗੈਰਾ ਸੀ ਜਿੱਥੇ ਜਾਨਵਰ ਵਾਤਾਵਰਨ ਉੱਥੇ ਆਪਣੇ ਚਾਹ ਦੇ ਬਾਗ ਇੰਨੇ ਜ਼ਿਆਦਾ ਸੀਗਾ ਕਿ ਜੇ ਕਿ ਅਸੀਂ ਦੇਖ ਕੇ ਮਨਮੋਹਕ ਖਿਲਦਾ ਸੀਗਾ ਕਿ ਇੰਨਾ ਸੋਹਣਾ ਵਾਤਾਵਰਨ ਮੈਂ ਕਦੇ ਨਹੀਂ ਦੇਖਿਆ ਸੀਗਾ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਅਤੇ ਮੇਰਾ ਦਿਲ ਕਰਦਾ ਕਿ ਫਿਰ ਵੀ ਜੇ ਕਦੇ ਮੌਕਾ ਮਿਲਿਆ ਕੇਰਲਾ ਤਾਂ ਗਏ ਹੀ ਗਏ ਹਾਂ ਅਸੀਂ ਉਹਦੇ ਅੱਗੇ ਗੋਆ ਅਤੇ ਮੇਰਾ ਮਨ ਕਰਦਾ ਕਿ ਗੋਆ ਵੀ ਜਾਈਏ ਕਿ ਸਮੁੰਦਰ ਉੱਥੇ ਤਾਂ ਬੀਚਾਂ ਬਹੁਤ ਵਧੀਆ ਨੇ ਕਿ ਉੱਥੇ ਜਾ ਕੇ ਜ਼ਰੂਰ ਦੇਖ ਕੇ ਆਈਏ ਅਤੇ ਇਸੇ ਤਰ੍ਹਾਂ ਹੀ ਕਿਤੇ ਨਾ ਕਿਤੇ ਜਾਂਦੇ ਰਹੀਏ